ਵੀਹ ਮਈ ਉੱਨੀ ਸੌ ਚੁਰਾਨਵੇਂ ਗਿਆਰਾਂ ਨਵੰਬਰ ਉੱਨੀ ਸੌ ਸੱਠ ਸੋਲ੍ਹਾਂ ਅਪ੍ਰੈਲ ਉੱਨੀ ਸੌ ਤ੍ਰਿਆਸੀ ਅਠਾਰਾਂ ਸਪਤੰਬਰ ਉੱਨੀ ਸੌ ਤ੍ਰੇਹਠ ਅਠਾਰਾਂ ਮਾਰਚ ਦੋ ਹਜ਼ਾਰ ਇੱਕੀ